ਮੈਂ ਨਵਨੀਤਨ ਖੇਡਾਂ ਦੀ ਖਬਰਾਂ ਅਤੇ ਸਮਾਗਮ ਦੀ ਅਪਡੇਟ ਲਈ ਫੋਨ ਜਾਂ ਟੀਵੀ ਦੀ ਵਰਤੋਂ ਕਰਦਾ ਹਾਂ ਮੇਰੀ ਮਨਪਸੰਦੀ ਦੀਆਂ ਖੇਡਾਂ ਕ੍ਰਿਕਟ ਬੈਡਮਿੰਟਨ ਚਿੜੀ ਛਿੱਕਾ ਅਤੇ ਫੁੱਟਬਾਲ ਹਨ ਫੁੱਟਬਾਲ ਦੇ ਦੋ ਬਹੁਤ ਹੀ ਮਸ਼ਹੂਰ ਨਾਮ ਮੈਸੀ ਅਤੇ ਰੋਨਾਲਡੋ ਦੁਨੀਆਂ ਦੇ ਸਭ ਤੋਂ ਵੱਡੇ ਫੁੱਟਬਾਲ ਪਲੇਅਰ ਹਨ ਬਾਕੀ ਬੈਡਮਿੰਟਨ ਮਤਲਬ ਕਿ ਚਿੜੀ ਛਿੱਕਾ ਜਿਹਨੂੰ ਕਹਿੰਦੇ ਹਨ ਉਹ ਮੈਂ ਹਰ ਐਤਵਾਰ ਦੇ ਐਤਵਾਰ ਖੇਡਦਾ ਰਹਿੰਦਾ ਹਾਂ ਸਾਡੇ ਲਾਗੇ ਇੱਕ ਪਾਰਕ ਹੈ ਮੈਂ ਉਸ ਵਿੱਚ ਜਾ ਕੇ ਖੇਡਦਾ ਹਾਂ ਕ੍ਰਿਕਟ ਕ੍ਰਿਕਟ ਇੱਕ ਇਸ ਤਰ੍ਹਾਂ ਦਾ ਖੇਡ ਹੈ ਜਿਸ ਦਾ ਹਰ ਇੱਕ ਨੂੰ ਪਤਾ ਹੈ ਹਰ ਇੱਕ ਦੀ ਜ਼ੁਬਾਨ 'ਚ ਨਾ ਕ੍ਰਿਕਟ ਕ੍ਰਿਕਟ ਹੀ ਹੁੰਦਾ ਹੈ ਅੱਜ ਕੱਲ੍ਹ ਆਈ ਪੀ ਐਲ ਦਾ ਸੀਜ਼ਨ ਹੈ ਜਿਸ ਵਿੱਚ ਕਿ ਟੀਮਾਂ ਬਣਦੀਆਂ ਹਨ ਅਤੇ ਖੇਡੇ ਜਾਂਦੇ ਹਨ ਮੇਰੀ ਪਸੰਦੀਦਾ ਟੀਮ ਮੁੰਬਈ ਅਤੇ ਗੁ ਗੁਜਰਾਤ ਹੈ ਮੇਰੇ ਮਨ ਪਸੰਦੀਦੇ ਪਲੇਅਰ ਹਾਰਦਿਕ ਪਾਂਡਿਆ ਅਤੇ ਸ਼ੁ ਸ਼ੁੱਭਮਨ ਗਿੱਲ ਹਨ ਉਹ ਬਹੁਤ ਹੀ ਵਧੀਆ ਪਲੇਅਰ ਹਨ ਉਹ ਇੰਡੀਆ ਟੀਮ ਦਾ ਵੀ ਹਿੱਸਾ ਹਨ ਅਤੇ ਉਹਨਾਂ ਨੇ ਬਹੁਤ ਹੀ ਵਧੀਆ ਵਧੀਆ ਤਰ੍ਹਾਂ ਨਾਲ ਖੇਡ ਕੇ ਮੈਚ ਨੂੰ ਜਿਤਾਇਆ ਹੈ ਸ਼ੁੱਭਮਨ ਗਿੱਲ ਇੱਕ ਬੈਟਰ ਹੈ ਅਤੇ ਹਾਰਦਿਕ ਪਾਂਡਿਆਂ ਇੱਕ ਆਲ ਰਾਊਂਡਰ ਹੈ ਦੋਵਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ ਦੋਵਾਂ ਦੀ ਫਿਟਨੈਸ ਅਤੇ ਆਪਣੇ ਆਪ ਨੂੰ ਹੋਰ ਵਧੀਆ ਕਰਨ ਦੀ ਰੂਟੀਨ ਦੇਖ ਕੇ ਮੇਰਾ ਵੀ ਇਹੀ ਛੋਟੇ ਹੁੰਦੇ ਦਾ ਸੁਪਨਾ ਸੀ ਕਿ ਮੈਂ ਕ੍ਰਿਕਟਰ ਬਣਾਂ ਬਟ ਕੁਝ ਗੱਲਾਂ ਕਰਕੇ ਮੈਂ ਬਣ ਨਹੀਂ ਸਕਿਆ ਬਾਕੀ ਖੇਡਾਂ ਦੇਖਣੀਆਂ ਸਭ ਨੂੰ ਚਾਹੀਦੀਆਂ ਹਨ ਇਹ ਤੁਹਾਨੂੰ ਤਕੜਾ ਰਹਿਣ ਦੀ ਦੱਸਦੇ ਹਨ